ਅਸੀਂ ਜ਼ਿਆਦਾਤਰ ਘਰ ਵਿੱਚ ਫਲ ਦੇ ਬੂਟੇ ਪੌਦੇ ਲਗਾਏ ਹੋਏ ਹਨ ਘਰ ਦੇ ਵਿਹੜੇ ਵਿੱਚ ਫਲਾਂ ਵਾਲੇ ਬੂਟੇ ਅਤੇ ਸਬਜ਼ੀਆਂ ਦੀਆਂ ਵੇਲਾਂ ਲਗਾਈਆਂ ਹੋਈਆਂ ਹਨ ਘਰ ਵਿੱਚ ਅਮਰੂਦ ਆੜੂ ਅਤੇ ਪਪੀਤੇ ਦੇ ਪੌਦੇ ਲਗਾਏ ਹੋਏ ਹਨ ਜਿਨ੍ਹਾਂ ਦਾ ਧਿਆਨ ਮੇਰਾ ਸਾਰਾ ਪਰਿਵਾਰ ਰੱਖਦਾ ਹੈ ਘਰ ਦੀ ਛੱਤ ਅਤੇ ਕੰਧ ਅਤੇ ਕੰਧ ਦੇ ਰਸਤੇ ਨਾਲ ਲਗਾਏ ਪਲਾਟ ਵਿੱਚ ਵੀ ਕੁਝ ਦਰੱਖਤ ਅਤੇ ਸਬਜ਼ੀਆਂ ਦੀਆਂ ਬੇਲਾਂ ਅਤੇ ਬੂਟੇ ਲਗਾਏ ਹੋਏ ਹਨ ਬੇਲਾਂ ਵਿੱਚ ਜਿਵੇਂ ਤੋਰੀਆਂ ਦੀ ਵੇਲ ਘਈਏ ਦੀ ਵੇਲ ਅਤੇ ਮਿਰਚਾਂ ਦੇ ਬੂਟੇ ਅਤੇ ਗਾਜਰਾਂ ਮੂਲੀਆਂ ਆਦਿ ਦੇ ਬੂਟੇ ਲਗਾਏ ਹੋਏ ਹਨ